ਜੋ ਕਿ ਮੈਂ ਇੱਕ ਤੁਹਾਡੀ ਦੁਕਾਨ ਤੋਂ ਲੈਪਟੋਪ ਖਰੀਦਿਆ ਸੀ ਉਸ ਵਿੱਚ ਤੁਸੀਂ ਉਸ ਦੀਆਂ ਵ ਕਈ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ ਸਨ ਕਿ ਤੁਸੀਂ ਦੱਸਿਆ ਸੀ ਕਿ ਇਹ ਡੈਲ ਕੰਪਨੀ ਦਾ ਲੈਪਟੋਪ ਸਭ ਤੋਂ ਵਧੀਆ ਹੈ ਇਸ ਵਿੱਚ ਕਈ ਵਿਸ਼ੇਸ਼ਤਾ ਦੱਸੀਆਂ ਸੀ ਕਿ ਜਿਵੇਂ ਕਿ ਇਹ ਹੈਂਗ ਨਹੀਂ ਹੁੰਦਾ ਇਹਦਾ ਪ੍ਰੋਸੈਸਿੰਗ ਵੀ ਕਾਫੀ ਫਾਸਟ ਹੈ ਇਹ ਗਰਮ ਵੀ ਨਹੀਂ ਹੁੰਦਾ ਮੈਂ ਆਪ ਜੀ ਦੇ ਵਿਸ਼ਵਾਸ ਉੱਤੇ ਕਾਇਮ ਹੋ ਕੇ ਇਹ ਲੈਪਟੋਪ ਪੰਦਰ੍ਹਾਂ ਹਜ਼ਾਰ ਰੁਪਏ ਵਿੱਚ ਖਰੀਦ ਲਿਆ ਪਰ ਜਦੋਂ ਮੈਂ ਇਸ ਦੀ ਵਰਤੋਂ ਸ਼ੁਰੂ ਕੀਤੀ ਤਾਂ ਇਸ ਵਿੱਚ ਮੈਨੂੰ ਤੁਰੰਤ ਹੀ ਕਈ ਖਾਮੀਆਂ ਮਿਲਣ ਲੱਗੀਆਂ ਜਿਵੇਂ ਕਿ ਇਹ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਸੀ ਹੈਂਗ ਹੋ ਜਾਂਦਾ ਸੀਗਾ ਕਈ ਤਰ੍ਹਾਂ ਦੇ ਕੰਮ ਮੈਨੂੰ ਕਰਨ ਵਿੱਚ ਇਸ ਉੱਤੇ ਦਿੱਕਤ ਦਾ ਸਾਹਮਣਾ ਕਰਨਾ ਪਿਆ ਇਸ ਸਬੰਧਤ ਮੈਂ ਕਈ ਤਰ੍ਹਾਂ ਦੇ ਮਕੈਨਿਕਾਂ ਕੋਲ੍ਹੋਂ ਇਸ ਦੀ ਮੁਰੰਮਤ ਵਾਸਤੇ ਲੈ ਕੇ ਗਿਆ ਜੋ ਕਿ ਮੈਨੂੰ ਉਹਨਾਂ ਨੇ ਰਾਏ ਦਿੱਤੀ ਕਿ ਆਪ ਦਾ ਲੈਪਟਾਪ ਗਰੰਟੀ 'ਚ ਹੈ ਤੁਸੀਂ ਇਸ ਸੰਬੰਧਿਤ ਦੁਕਾਨਦਾਰ ਨਾਲ ਹੀ ਗੱਲ ਕਰੋ ਤਾਂ ਕਿ ਜੋ ਆਪ ਨੂੰ ਕੁਝ ਬੈਨੀਫਿਟ ਹੋ ਸਕੇ ਇਸ ਕਰਕੇ ਮੈਂ ਆਪ ਜੀ ਕੋਲ੍ਹ ਫਿਰ ਆਇਆ ਹਾਂ ਕਿ ਆਪ ਜੀ ਇਸ ਲੈਪਟੋਪ ਨੂੰ ਦੇਖੋ ਜਾਂ ਇਸ ਦਾ ਮੈਨੂੰ ਕੋਈ ਹੱਲ ਕਰਕੇ ਦਿਉ ਜੋ ਕਿ ਮੈਂ ਇਸਨੂੰ ਤਾਂ ਆਪਦੀ ਸੁਵਿਧਾ ਖਾਤਰ ਖਰੀਦਿਆ ਸੀ ਪਰ ਇਸ ਨੇ ਤਾਂ ਮੈਨੂੰ ਕਈ ਤਰ੍ਹਾਂ ਦੀਆਂ ਦੁਵਿਧਾ ਵਿੱਚ ਪਾ ਦਿੱਤਾ ਹੈ ਜਾਂ ਤਾਂ ਇਸ ਦੀ ਆਪ ਸਹੀ ਮੁਰੰਮਤ ਕਰਾ ਕੇ ਦਿਓ ਜਾਂ ਮੈਨੂੰ ਇਹਦੀ ਥਾਂ 'ਤੇ ਕੋਈ ਨਵਾਂ ਲੈਪਟੋਪ ਦਿੱਤਾ ਜਾਵੇ ਤਾਂ ਜੋ ਕਿ ਮੈਂ ਇਸ ਪਰੇਸ਼ਾਨੀ ਤੋਂ ਨਿਜਾਤ ਪਾ ਸਕਾਂ ਮੈਂ ਆਪਣਾ ਕੰਮ ਵਿੱਚ ਸਹੀ ਧਿਆਨ ਨਾਲ ਕਰ ਸਕਾਂ